ਅੱਜ ਦੇ ਸਮਾਜ ਵਿੱਚ ਲੋਕਾਂ ਦੁਆਰਾ ਬਹੁਤ ਸਾਰੀਆਂ ਪ੍ਰਥਾਂ ਅਤੇ ਰੀਤੀ ਰਿਵਾਜ਼ਾਂ ਨੂੰ ਖਤਮ ਕਰ ਦਿੱਤਾ ਗਿਆ ਹੈ ਪਹਿਲਾਂ ਬਾਲ ਵਿਵਾਹ ਜਿਸ ਵਿੱਚ ਛੋਟੀ ਉਮਰ ਵਿੱਚ ਹੀ ਬੱਚਿਆਂ ਦਾ ਵਿਵਾਹ ਕਰ ਦਿੱਤਾ ਜਾਂਦਾ ਸੀ ਉਸ ਪ੍ਰਥਾ ਨੂੰ ਸਮਾਜ ਨੇ ਖਤਮ ਕਰ ਦਿੱਤਾ ਗਿਆ ਹੈ ਹਿੰਦੂ ਸਮਾਜ ਵਿੱਚ ਚੱਲ ਰਹੀ ਸਥਿਤੀ ਇਸਤਰੀ ਪ੍ਰਥਾ ਜਿਸ ਵਿੱਚ ਔਰਤਾਂ ਨੂੰ ਪਤੀ ਦੇ ਮਰਨ ਦੇ ਪਿੱਛੋਂ ਹੀ ਉਹਨਾਂ ਦੀ ਚਿਤਾ ਨਾਲ ਮਾਰ ਦਿੱਤਾ ਜਾਂਦਾ ਸੀ ਉਸ ਪ੍ਰਥਾ ਨੂੰ ਵੀ ਸਮਾਜ ਨੇ ਖਤਮ ਕਰ ਦਿੱਤਾ ਗਿਆ ਹੈ ਅੱਜ ਕੱਲ੍ਹ ਦੇ ਸਮਾਜ ਵਿੱਚ ਔਰਤਾਂ ਦੀ ਸਿੱਖਿਆ ਵੱਲ ਵੀ ਧਿਆਨ ਦਿੱਤਾ ਜਾਂਦਾ ਹੈ ਕੰਨਿਆਂ ਦੀ ਭਰੂਣ ਹੱਤਿਆ ਨੂੰ ਵੀ ਖਤਮ ਕਰ ਦਿੱਤਾ ਗਿਆ ਹੈ ਜਾਤੀ ਦੇ ਨਾਂ 'ਤੇ ਭੇਦਭਾਵ ਕਰਨਾ ਕਾਫੀ ਘੱਟ ਗਿਆ ਹੈ ਦਹੇਜ ਪ੍ਰਥਾ ਆਦਿ ਤਰ੍ਹਾਂ ਦੀਆਂ ਪ੍ਰਥਾਵਾਂ ਨੂੰ ਰੋਕ ਦਿੱਤਾ ਗਿਆ ਹੈ ਨਕਸਲਵਾਦ ਵੀ ਖਤਮ ਹੋ ਗਿਆ ਹੈ ਅਤੇ ਜਾਤੀ ਦੇ ਆਧਾਰ 'ਤੇ ਭੇਦਭਾਵ ਕਰਨਾ ਵੀ ਬੰਦ ਹੋ ਗਿਆ ਹੈ